ਹੈਲੋ ਹਾਂ ਮੈਡਮ ਜੀ ਸਤਿ ਸ਼੍ਰੀ ਅਕਾਲ ਅਤੇ ਮੈਮ ਜੀ ਮੈਂ ਬੱਚਿਆਂ ਨੂੰ ਐਕਟੇਵਿਟੀ ਕਰਵਾਉਣੀ ਹੈ ਗੇਮਜ਼ ਬਾਰੇ ਕੁਛ ਜਾਣਕਾਰੀ ਲੈਣੀ ਸੀਗੀ ਤੁਹਾਡੇ ਕੋਲੋਂ

ਹਮ

ਹਾਂਜੀ

ਅੱਛਾ ਇੱਕ ਮੈਨੂੰ ਇੱਕ ਮੈਨੂੰ ਹੋਰ ਜਾਣਕਾਰੀ ਦਿਓ ਵੀ ਜਿਹੜੀਆਂ ਇਨਡੋਰ ਗੇਮਜ਼ ਆ ਅਤੇ ਆਊਟਡੋਰ ਜਿਹੜੀਆਂ ਖੇਡਾਂ ਨੇ ਇਨ੍ਹਾਂ ਦਾ ਜੀ ਫੀਸ ਵਗੈਰਾ ਵੀ ਲੱਗਦੀ ਹੈ ਗੱਲ ਇਹ ਹੈ ਵੀ ਚਲੋ ਕੋਈ ਨਹੀਂ ਮੈਂ ਕੱਲ੍ਹ ਨੂੰ ਤੁਹਾਡੇ ਸਕੂਲ ਆਊਂਗਾ ਆਫਿਸ ਆਊਂਗਾ ਅਤੇ ਫਿਰ ਫਿਰ ਆਪਾਂ ਡਿਸਕਸ ਕਰਾਂਗੇ ਹਾਂ ਠੀਕ ਹੈ ਠੀਕ ਹੈ

ਠੀਕ ਹੈ ਸਤਿ ਸ਼੍ਰੀ ਅਕਾਲ ਜੀ